ਪੰਜਾਬ ਦੀ ਸਿਆਸੀ ਪ੍ਰਣਾਲੀ ਦਾ ਮਤਲਬ ਹੈ ਕਿ ਪੰਜਾਬ ਦੇ ਲਈ ਮੰਤਰੀ ਚੁਣਨਾ ਜਾਂ ਫਿਰ ਕੋਈ ਵੀ ਲੀਡਰ ਚੁਣਨਾ ਇਸ ਦੇ ਵਿੱਚ ਬਹੁਤ ਵੱਡੀ ਇਸ ਦੇ ਵਿੱਚ ਬਹੁਤ ਵੱਡੀ ਗੱਲ ਹੈ ਜਿਸ ਦੇ ਵਿੱਚ ਵੋਟਿੰਗ ਕੀਤੀ ਜਾਂਦੀ ਹੈ ਜੋ ਕਿ ਆਮ ਲੋਕਾਂ ਦੁਆਰਾ ਕਰਵਾਈ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਕੁਝ ਪਾਰਟੀਆਂ ਆਪਣੀਆਂ ਆਪਣੀਆਂ ਲੀਡਰ ਖੁਦ ਚੁਣਦੇ ਆ ਸੀਟਾਂ ਲਈ ਠੀਕ ਹੈ ਅਤੇ ਜਿਸ ਵਿੱਚ ਅਲੱਗ ਅਲੱਗ ਰਾਜ ਦੇ ਵਿੱਚ ਅਲੱਗ ਅਲੱਗ ਲੀਡਰ ਚੁਣਿਆ ਜਾਂਦਾ ਆ ਅਤੇ ਉਹਦੇ ਲਈ ਜਿੱਦਾਂ ਭ੍ਰਿਸ਼ਟਾਚਾਰ ਬਹੁਤ ਘੱਟ ਹੁੰਦੀ ਹੈ ਅਤੇ ਲੋਅ ਅਤੇ ਆਰਡਰ ਬੜੀ ਚੰਗੇ ਤਰੀਕੇ ਨਾਲ ਮੰਨੇ ਜਾਂਦੇ ਆ ਅਤੇ